ਤਕਨੋਲਜੀ ਨੇ ਆਵਾਜਾਈ ਦੇ ਯੁੱਗ ਵਿੱਚ ਹੀ ਨਹੀਂ ਸਗੋਂ ਹਰ ਪਾਸੇ ਧੂਮ ਮਚਾ ਰੱਖੀ ਹੈ ਜਿਵੇਂ ਕਿ ਅੱਜ ਕੱਲ੍ਹ ਹਰ ਪਾਸੇ ਆਈ ਟੀ ਦਾ ਯੁੱਗ ਹੈ ਜਿਵੇਂ ਕਿ ਹਰ ਕੰਮ ਮਸ਼ੀਨੀ ਹੋ ਰਿਹਾ ਹੈ ਅਗਰ ਦੇਖਿਆ ਜਾਵੇ ਆਵਾਜਾਈ ਵਿੱਚ ਜਦੋਂ ਆਪਾ ਕਿਸੇ ਵੀ ਫਲਾਈਟ ਜਾਂ ਸਫ਼ਰ ਲਈ ਟਿਕਟ ਬੁੱਕ ਕਰਦੇ ਹਾਂ ਤਾਂ ਔਨਲਾਈਨ ਹੀ ਬੁੱਕ ਹੋ ਜਾਂਦੀ ਹੈ ਜਿਸ ਨਾਲ ਟਾਇਮ ਬਚਦਾ ਹੈ ਅਤੇ ਘੱਟ ਪੈਸੇ ਲੱਗਦੇ ਹਨ ਤੇ ਅੱਜ ਕੱਲ੍ਹ ਟੈਕਸ ਵੀ ਫਾਸਟ ਟੈਗ ਤੋਂ ਕੱਟ ਜਾਂਦੇ ਹਨ ਸਭ ਕੁਝ ਔਨਲਾਈਨ ਹੋ ਗਿਆ ਹੈ ਅਤੇ ਆਪਾਂ ਆਪਣੀ ਟਰੇਨ ਜਾਂ ਫਲੈਟ ਦਾ ਸਟੇਸਟ ਵੀ ਚੈੱਕ ਕਰ ਸਕਦੇ ਹਾਂ